ਖੇਡਾਂ ਸਾਡੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਪਰ ਇਸ ਨਾਲ ਸਾਨੂੰ ਕਈ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਖਾਸ ਕਰ ਕੁੜੀਆਂ ਨੂੰ ਜੇਕਰ ਕੋਈ ਕੁੜੀ ਖੇਡਣਾ ਚਾਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਉਸਨੂੰ ਆਪਣੇ ਘਰਦਿਆਂ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਕਈ ਕੁੜੀਆਂ ਨੂੰ ਤਾਂ ਖੇਡਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਜਾਂਦੀ ਕਿਉਂਕਿ ਉਹ ਕੁੜੀਆਂ ਨੂੰ ਖੇਡਣਾ ਕੁੱਦਣਾ ਪਸੰਦ ਨਹੀਂ ਕਰਦੇ ਜਦੋਂ ਵੀ ਕਿਸੇ ਕੁੜੀ ਨੂੰ ਖੇਡਣ ਦੀ ਪਰਮਿਸ਼ਨ ਵੀ ਮਿਲ ਜਾਂਦੀ ਹੈ ਕਈ ਵਾਰ ਉਸਨੂੰ ਘਰ ਦੀ ਕੰਡੀਸ਼ਨ ਉਹਦੀ ਐਵੇਂ ਦੀ ਹੁੰਦੀ ਹੈ ਕਿ ਉਹ ਖੇਡ ਨਹੀਂ ਸਕਦੀ ਵਧੀਆ ਵਧੀਆ ਟਰੈਕ ਸੂਟ ਨਹੀਂ ਲੈ ਸਕਦੀ ਬੂਟ ਨਹੀਂ ਲੈ ਸਕਦੀ ਜਿਸ ਕਾਰਨ ਉਹਨਾਂ ਨੂੰ ਖੇਡਾਂ ਛੱਡਣੀਆਂ ਪੈ ਜਾਂਦੀਆਂ ਹਨ ਕਈ ਵਾਰ ਐਵੇਂ ਦੇ ਕੋਚ ਮਿਲ ਜਾਂਦੇ ਹਨ ਜੋ ਕਿ ਸਾਨੂੰ ਚੰਗੀ ਤਰ੍ਹਾਂ ਗਾਈਡ ਨਹੀਂ ਕਰਦੇ ਅਤੇ ਕਈ ਵਾਰ ਸਾਡੇ ਕੁਝ ਇਹੋ ਜਿਹੇ ਨਾਲ ਦੇ ਖਿਡਾਰੀ ਹੁੰਦੇ ਹਨ ਜੋ ਸਾਨੂੰ ਦੇਖ ਕੇ ਈਰਖ਼ਾ ਕਰਦੇ ਹਨ ਅਤੇ ਸਾਡੀ ਸਪੋਰਟਸ ਨੂੰ ਸਪੋਟ ਨਹੀਂ ਕਰਦੇ ਜਿਸ ਕਾਰਨ ਸਾਨੂੰ ਬਹੁਤ ਜ਼ਿਆਦਾ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰ ਘਰ ਤੋਂ ਦੂਰ ਹੋਣ ਕਾਰਨ ਘਰ ਤੋਂ ਦੂਰ ਹੋਣ ਕਾਰਨ ਕੁੜੀਆਂ ਨੂੰ ਜਾਣ ਦੀ ਆਜ਼ਾਦੀ ਵੀ ਨਹੀਂ ਮਿਲਦੀ ਕਿਉਂਕਿ ਕੋਈ ਵੀ ਪੇਰੈਂਟਸ ਨਹੀਂ ਚਾਹੁੰਦਾ ਹੈ ਕਿ ਉਸਦੀ ਕੁੜੀ ਘਰ ਤੋਂ ਬਹੁਤ ਦੇਰ ਤੱਕ ਦੂਰ ਰਹੇ ਜਿਸ ਕਾਰਨ ਸਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ